ਪਸ਼ੂ ਪਾਲਣ ਦਾ ਕਿੱਤਾ ਵੀ ਪੇਂਡੂ ਇਲਾਕੇ ਵਿੱਚ ਕਾਫੀ ਲੋਕਾਂ ਵੱਲੋਂ ਅਪਣਾਇਆ ਜਾਂਦਾ ਹੈ ਜਿਸ ਵਿੱਚ ਗਊਆਂ ਭੇਡਾਂ ਬੱਕਰੀਆਂ ਮੁਰਗੀਆਂ ਆਦਿ ਸ਼ਾਮਿਲ ਹਨ ਪਸ਼ੂ ਪਾਲਣ ਦੇ ਕੰਮ ਛੋਟੇ ਖੇਤਰ ਦੇ ਲੋਕਾਂ ਨੇ ਖੁੱਲ੍ਹੀਆਂ ਜਗਾਵਾਂ 'ਤੇ ਕੀਤਾ ਹੁੰਦਾ ਕਈ ਥਾਵਾਂ 'ਤੇ ਗਊਸ਼ਾਲਾ ਵੀ ਬਣੀ ਹੁੰਦੇ ਹਨ ਭੇਡਾਂ ਵੀ ਸਾਨੂੰ ਉੱਨ ਪ੍ਰਦਾਨ ਕਰਦੀਆਂ ਹਨ ਜੋ ਕਿ ਸਰਦੀ ਦੀ ਰੁੱਤ ਵਿੱਚ ਸਾਨੂੰ ਨਿੱਘੇ ਰੱਖਦੇ ਹਨ ਬੱਕਰੀਆਂ ਸਾਨੂੰ ਦੁੱਧ ਪ੍ਰਦਾਨ ਕਰਦੀਆਂ ਹਨ ਅਜੋਕੇ ਸਮੇਂ ਵਿੱਚ ਬੱਕਰੀ ਦਾ ਦੁੱਧ ਕਾਫੀ ਮਹਿੰਗਾ ਹੈ ਜੋ ਕਿ ਸਾਡੇ ਸਰੀਰ ਦੇ ਸੈੱਲਾਂ ਦੀ ਮਾਤਰਾ ਨੂੰ ਵਧਾਉਣ ਵਿੱਚ ਮਦਦ ਕਰਦਾ ਹੈ ਮੁਰਗੀਆਂ ਆਂਡਾ ਅਤੇ ਮੀਟ ਪ੍ਰਦਾਨ ਕਰਦੀਆਂ ਹਨ ਜੋ ਕਿ ਮਾਸਾਹਾਰੀ ਖਾਣ ਵਾਲੇ ਲੋਕਾਂ ਦਾ ਭੋਜਨ ਸਰੋਤ ਹੈ ਇਹਨਾਂ ਤੋਂ ਇਲਾਵਾ ਲੋਕ ਮੱਛੀ ਪਾਲਣ ਸੂਰ ਪਾਲਣ ਮਧੂ ਮੱਖੀ ਪਾਲਣ ਦਾ ਵੀ ਕੰਮ ਕਰਦੇ ਹਨ ਪਸ਼ੂ ਪਾਲਣ ਦੀ ਪ੍ਰਕਿਰਿਆ ਦੁਆਰਾ ਲੋਕ ਆਪਣੇ ਨਿੱਜੀ ਖਰਚੇ ਕੱਢਦੇ ਹਨ ਅਤੇ ਉਹਨਾਂ ਨੇ ਆਪਣੇ ਪੱਕੇ ਆਮਦਨ ਦੇ ਸਰੋਤ ਬਣਾਏ ਹੋਏ ਹਨ